ਹ ਹੈਲੋ ਹਾਂਜੀ ਜੀ ਹਾਂਜੀ ਗੁਪਤਾ ਸੈਂਟਰ ਹੀ ਗੱਲ ਕਰ ਰਹੇ ਹੈ ਹਾਂਜੀ ਜੀ ਬਿਲਕੁਲ ਹੋਣਗੀਆਂ ਪੰਜਾਬੀ ਵਿਆਕਰਣ ਸਾਰੀਆਂ ਅਵੇਲੇਬਲ ਨੇ ਜੀ ਕੰਪਿਊਟਰ ਦੀ ਤਾਂ ਵੈਸੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਦੀ ਸਾਰੀ ਕਿਤਾਬਾਂ ਨੇ ਅਤੇ ਪਲੱਸ ਵਨ ਪਲੱਸ ਟੂ ਦੀਆਂ ਵੀ ਮਿਲ ਜਾਣਗੀਆਂ ਡਿਸਕਾਊਂਟ ਤਾਂ ਜੀ ਦਸ ਪਰਸੈਂਟ ਹੀ ਦਿੰਦੇ ਹਾਂ ਹਾਂਜੀ ਬਿਲਕੁਲ ਕਰਨੇ ਆ ਲੈਣਾ ਜੀ ਤੁਸੀਂ

ਪੰਦਰ੍ਹਾਂ ਸੌ ਪੰਦਰ੍ਹਾਂ ਸੌ ਦਾ ਪੈ ਜਾਵੇਗਾ ਵੀਹ ਪਰਸੈਂਟ

ਜੀ ਟ੍ਰਾਂਸਪੋਜੇਸ਼ਨ ਚਾਰਜਿਸ ਵੱਖਰੇ ਲੱਗਦੇ ਹੈ ਉਹਦੇ ਹੰਡਰ ਰੁਪੀਜ਼ ਠੀਕ ਹੈ ਜੀ ਠੀਕ ਹੈ ਅਸੀਂ ਕਹਿ ਦਾਂਗੇ ਹੋਰ ਕੁਝ ਮਹੀਨੇ ਡੇਢ ਮਹੀਨੇ ਤੱਕ ਅਤੇ ਐਡਰੈਸ ਕੀ ਹੈ ਤੁਹਾਡਾ ਠੀਕ ਹੈ ਚੰਡੀਗੜ੍ਹ ਠੀਕ ਹੈ ਮੈਮ ਕਰ ਦਾਂਗੇ ਅਸੀਂ ਓਕੇ ਵੈਲਕਮ